ਦੁਨੀਆਂ 'ਤੇ ਹਰ ਇੱਕ ਬੰਦਾ ਹੈ ਜਿਸ ਨਾਲ ਕੋਈ ਨਾ ਕੋਈ ਚੰਗੀ ਚੀਜ਼ ਵਾਪਰੀ ਜਾਂਦੀ ਹੈ ਜਿਵੇਂ ਕਿ ਉਸਨੂੰ ਕੋਈ ਵਧੀਆ ਚੀਜ਼ ਮਿਲੀ ਹੁੰਦੀ ਹੈ ਜਿਵੇਂ ਕਿ ਬਾਈਕ ਜਾਂ ਉਹ ਕਿਤੇ ਗਿਆ ਹੁੰਦਾ ਹੈ ਜਿੱਥੇ ਕਿ ਉਸਨੇ ਜਿੱਤਿਆ ਹੋਇਆ ਮੈਚ ਦੇਖਿਆ ਹੋਵੇ ਮੈਂ ਵੀ ਤੁਹਾਨੂੰ ਉਸ ਚੀਜ਼ ਬਾਰੇ ਦੱਸਣ ਜਾ ਰਹੀ ਹਾਂ ਮੈਂ ਜਦ ਨੌ ਸਾਲ ਦੀ ਸੀ ਅਤੇ ਮੇਰੇ ਘਰ ਵਾਲੇ ਸਾਰੇ ਹੀ ਅਸੀਂ ਧਰਮਸ਼ਾਲਾ ਮੈਚ ਵੇਖਣ ਲਈ ਗਏ ਸੀ ਮੈਚ ਤਾਂ ਬਹੁਤ ਹੀ ਇੰਟਰਸਟਿੰਗ ਸੀ ਪੰਜਾਹ ਓਵਰਾਂ 'ਚ ਤਾਂ ਆਸਟਰੇਲੀਆ ਦੇ ਢਾਈ ਸੌ ਸਕੋਰ ਸੀ ਅਠਵੰਜਾ ਓਵਰਾਂ 'ਚ ਮੈਚ ਪੂਰਾ ਹੀ ਫਸਵਾਂ ਮੁਕਾਬਲਾ ਦੇ ਰਿਹਾ ਸੀ ਜਿਸ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਸਨ ਪਰ ਇੰਡੀਆ ਅੱਠ ਸਕੋਰ ਤੋਂ ਜਿੱਤਿਆ ਇੰਡੀਆ ਦੀ ਟੀਮ ਦਾ ਕੋਚ ਰਵੀ ਸ਼ਾਸਤਰੀ ਬਹੁਤ ਖੁਸ਼ ਹੋਇਆ ਅਤੇ ਬੜਾ ਹੀ ਉਸ ਸਮੇਂ ਵਧੀਆ ਮੂਮੈਂਟ ਸੀ